ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਹਰਪਿੰਦਰ ਸਿੰਘ ਬੋਲਦਾ ਜੀ ਮੈਂ ਅੱਜ ਸੁਬਾਹ ਤੁਹਾਡੀ ਕੰਪਨੀ ਤੋਂ ਕੈਬ ਬੁੱਕ ਕਰਵਾਈ ਸੀ ਦਰਅਸਲ ਮੈਂ ਚੰਡੀਗੜ੍ਹ ਤੋਂ ਜ਼ੀਰਕਪੁਰ ਜਾਣਾ ਸੀ ਆਪਣੀ ਔਫ਼ਿਸ ਦੀ ਮੀਟਿੰਗ ਕਰਨ ਅਤੇ ਮੈਂ ਕੈਬ ਦਾ ਸਮਾਂ ਦੋ ਵਜੇ ਦਾ ਕੀਤਾ ਹੋਇਆ ਸੀ ਅਤੇ ਹੁਣ ਤਿੰਨ ਵੱਜ ਚੁੱਕੇ ਹਨ ਮੈਂ ਦਿੱਤੇ ਹੋਏ ਸਥਾਨ 'ਤੇ ਦੋ ਵਜੇ ਦਾ ਖੜ੍ਹਾ ਹਾਂ ਅਤੇ ਤੁਹਾਡੀ ਕੈਬ ਹੁਣ ਤੱਕ ਤਿੰਨ ਵਜੇ ਤੱਕ ਉਰੇ ਨਹੀਂ ਪਹੁੰਚੀ ਹੈ ਅਤੇ ਮੈਂ ਬਹੁਤ ਹੀ ਨਿਰਾਸ਼ਾ ਤੁਹਾਡੀ ਕੈਬ ਨੂੰ ਰੱਦ ਕਰ ਰਿਹਾ ਹਾਂ ਅਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੀ ਬਣਦੀ ਪੇਮੈਂਟ ਜੋ ਮੈਂ ਤੁਹਾਨੂੰ ਅਡਵਾਂਸ ਕੀਤੀ ਸੀ ਉਹ ਮੇਰੀ ਵਾਪਸ ਕਰ ਦਿਉ ਕਿਉਂਕਿ ਤੁਹਾਡੀ ਇੱਕ ਕੈਬ ਦੀ ਲਾਪਰਵਾਹੀ ਕਾਰਨ ਮੇਰੀ ਜੋ ਮੀਟਿੰਗ ਸੀ ਉਹ ਖ਼ਰਾਬ ਹੋ ਚੁੱਕੀ ਹੈ ਸੋ ਮੇਰੀ ਬਣਦੀ ਪੇਮੈਂਟ ਮੈਨੂੰ ਵਾਪਸ ਕਰ ਦੋ ਧੰਨਵਾਦ